ਜਿਵੇਂ ਆਪਾਂ ਜਾਣਦੇ ਹਾਂ ਵੀ ਅੱਜ ਕੱਲ੍ਹ ਦਾ ਜਮਾਨਾ ਸਭ ਔਨਲਾਈਨ ਹੋ ਚੁੱਕਿਆ ਹੈ ਆਪਣਾ ਫੋਨ 'ਤੇ ਸਭ ਕੁਛ ਸਭ ਕੰਮ ਹੋ ਜਾਂਦਾ ਹੈ ਹੁਣ ਬਾਜ਼ਾਰ ਜਾਣਾ ਆਪਣਾ ਕੱਪੜੇ ਖਰੀਦਦਾਰੀ ਕਰਨਾ ਉਹ ਵੀ ਕੰਮ ਸਭ ਔਨਲਾਈਨ ਹੋ ਚੁੱਕਿਆ ਹੈ ਤਾਂ ਹਾਲ ਹੀ ਦੇ ਵਿੱਚ ਮੈਂ ਵੀ ਇਸ ਦਾ ਹਾ ਫਾਇਦਾ ਉਠਾਇਆ ਔਨਲਾਈਨ ਸ਼ੋਪਿੰਗ ਕਰਕੇ ਔਨਲਾਈਨ ਸ਼ੋਪਿੰਗ ਦੇ ਵਿੱਚ ਮੈਂ ਬੱਚਿਆਂ ਦੇ ਲਈ ਉਹਨਾਂ ਦੀ ਰਸਾਲੇ ਮੰਗਵਾਏ ਕਿਤਾਬ ਮੰਗਵਾਈ ਤਾਂ ਉਹ ਜੋ ਰਸਾਲਾ ਸੀ ਉਹ ਕਿਤਾਬ ਸੀ ਉਹਦੀ ਮੈਨੂੰ ਘਰ ਬੈਠੇ ਹੀ ਮੈਂ ਔਨਲਾਈਨ ਸ਼ੋਪਿੰਗ ਦੇ ਜ਼ਰੀਏ ਮੈਂ ਦੇਖ ਸਕਦਾ ਸੀ ਵੀ ਉੱਥੇ ਇਹਨਾਂ ਦੀ ਵੈਬਸਾਈਟ ਦੇ ਉੱਪਰ ਆਪਾਂ ਦੇਖ ਸਕਦੇ ਹਾਂ ਵੀ ਉਹ ਕਿਸ ਤਰੀਕੇ ਦਾ ਆਪਣਾ ਜਿਹੜਾ ਕਿਤਾਬ ਹੈ ਉਹ ਕਿਸ ਤਰੀਕੇ ਦੀ ਬਣੀ ਹੋਈ ਹੈ ਉਹਦੀ ਬਣਤਰ ਕਿੱਦਾਂ ਦੀ ਹੈ ਉਹਦੇ ਅੰਦਰ ਦੇ ਪੇਜ ਹੈ ਜਿਹੜੇ ਵਰਕੇ ਨੇ ਪੰਨੇ ਉਹ ਕਿਸ ਤਰੀਕੇ ਦੇ ਬਣੇ ਹੋਏ ਹਨ ਤਾਂ ਉਹ ਅਤੇ ਜਦੋਂ ਮੈਂ ਇਹ ਆਡਰ ਕਰਿਆ ਅਤੇ ਇਹ ਘਰ ਆਇਆ ਤਾਂ ਮੈਂ ਬਹੁਤ ਸੁਣਿਆ ਸੀ ਇਸ ਬਾਰੇ ਵੀ ਕਿ ਜਦੋਂ ਆਪਾਂ ਕੋਈ ਵੀ ਚੀਜ਼ ਮੰਗਵਾਉਂਦੇ ਹਾਂ ਤਾਂ ਜਿਸ ਤਰੀਕੇ ਆਪਾਂ ਦੇਖਦੇ ਹਾਂ ਉਸ ਤਰੀਕੇ ਦੀ ਨਹੀਂ ਮਿਲਦੀ ਪਰ ਇਹ ਕਿਤਾਬ ਸੱਚੀ ਬਹੁਤ ਵਧੀਆ ਸੀ ਅਤੇ ਮੈਨੂੰ ਵੀ ਬਾਜ਼ਾਰ ਦੇ ਰੇਟਾਂ ਨਾਲੋਂ ਬਹੁਤ ਸਸਤੇ ਦੇ ਵਿੱਚ ਵੀ ਮਿਲ ਗਈ ਅਤੇ ਇਸ ਕਿਤਾਬ ਦੀ ਬਹੁਤ ਅੱਛੀ ਖ਼ਾਸੀਅਤ ਇਹ ਸੀ ਕਿ ਇਹਦੀ ਕੁਆਲਿਟੀ ਸੀ ਜਿਹੜੀ ਉਹ ਬਹੁਤ ਵਧੀਆ ਸੀ ਇਹਦੇ ਪੇਜ ਇਹਦੇ ਪੰਨੇ ਉਹ ਬਹੁਤ ਸਾਫ਼ ਸਨ ਇਹਦੇ 'ਤੇ ਬਣੇ ਹੋਏ ਚਿੱਤਰ ਉਹ ਇਕਦਮ ਸਾਫ਼ ਸਨ ਅਤੇ ਲਿਖਤੀ ਇਕਦਮ ਬੱਚਿਆਂ ਦੇ ਅ ਬੱਚਿਆਂ ਦੇ ਲਈ ਬਣੀ ਹੋਈ ਸੀ ਜਿਸ ਤਰੀ ਜਿਸ ਤਰੀਕੇ ਦੇ ਰੰਗ ਬੱਚੇ ਸਮਝਦੇ ਹਨ ਜਿਸ ਤਰੀਕੇ ਦੀ ਫੋਟੋ ਬੱਚੇ ਸਮਝਦੇ ਹਨ ਉਸ ਤਰੀਕੇ ਦੀ ਬਣਤਰ ਸੀ ਮੈਨੂੰ ਇਹ ਇਹ ਮੈਨੂੰ ਇਹ ਤਜਰਬਾ ਬਹੁਤ ਵਧੀਆ ਲੱਗਿਆ ਇਹ ਔਨ ਔਨਲਾਈਨ ਸ਼ਾਪਿੰਗ ਕਰਨਾ ਬਹੁਤ ਚੰਗਾ ਲੱਗਿਆ